ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਲਾਜ਼ਮੀ ਹੀ ਬਾਈਕਿੰਗ ਨੂੰ ਪ੍ਰਭਾਵਿਤ ਕਰਦੀਆਂ ਨੇ ਅਤੇ ਇਸ ਦੀ ਵਰਤੋਂ ਲੋੜ ਅਨੁਸਾਰ ਹੀ ਕੀਤੀ ਜਾਣੀ ਚਾਹੀਦੀ ਹੈ ਵੱਧ ਤੋਂ ਵੱਧ ਸਾਈਕਲ ਦੀ ਵਰਤੋਂ ਪੈਟਰੋਲ ਦੀ ਖਪਤ ਨੂੰ ਘਟਾ ਸਕਦੀ ਹੈ ਅਤੇ ਇਹਦੇ ਨਾਲ ਜੋ ਜੇਬ ਖਰਚ ਉੱਤੇ ਵਜ਼ਨ ਘੱਟਦਾ ਹੈ ਅਤੇ ਪੈਟਰੋਲ ਬਲਣ ਦੇ ਨਾਲ ਜੋ ਗੈਸਾਂ ਦਾ ਉਤਪਾਦਨ ਵਾਤਾਵਰਨ ਦੇ ਵਿੱਚ ਹੁੰਦਾ ਹੈ ਉਹ ਤੋਂ ਵੀ ਬਚਿਆ ਜਾ ਸਕਦਾ ਹੈ ਸੋ ਦੋਹਰੇ ਫਾਇਦੇ ਹਨ ਕਿ ਅਸੀਂ ਲੋੜ ਅਨੁਸਾਰ ਹੀ ਪੈਟਰੋਲ ਵਾਲੀਆਂ ਜੋ ਚਾਹੇ ਮੋਟਰਸਾਈਕਲ ਹੈ ਚਾਹੇ ਕਾਰ ਹੈ ਉਹਦੀ ਵਰਤੋਂ ਸੀਮਤ ਤੌਰ 'ਤੇ ਕਰੀਏ ਅਤੇ ਵੱਧ ਤੋਂ ਵੱਧ ਸਾਈਕਲ ਦੀ ਵਰਤੋਂ ਕਰੀਏ ਜਾਂ ਪੈਦਲ ਚੱਲ ਕੇ ਜੋ ਨੇੜਲੇ ਸਥਾਨ ਨੇ ਉਹਨਾਂ ਨੂੰ ਉਹਨਾਂ 'ਤੇ ਚੱਲਿਆ ਜਾ ਸਕਦਾ ਹੈ ਇਹਦੇ ਨਾਲ ਸਿਹਤ ਵੀ ਜਿਹੜੀ ਹੈ ਉਹ ਠੀਕ ਰਹੇਗੀ ਅਤੇ ਵਾਤਾਵਰਣ ਦੇ ਉੱਤੇ ਵੀ ਬੋਝ ਘਟੇਗਾ